ਸਾਡੇ ਪਿੰਡ ਵਿੱਚ ਖਰ ਐਬੂਲੈਂਸ ਖ਼ਰਾਬ ਹੋ ਗਈ ਹੈ ਜਿਸ ਕਾਰਨ ਸਾਨੂੰ ਬਹੁਤ ਦਿੱਕਤ ਆਉਂਦੀ ਹੈ ਇੱਧਰ ਸਾਨੂੰ ਕਿਸੀ ਨੇ ਕਿਹਾ ਕਿ ਤੁਸੀਂ ਆਪਣੇ ਪਿੰਡ ਜਾ ਕੇ ਬੋਲੋ ਕੀ ਕਿ ਸ ਜੋ ਸਰਪੰਚ ਹੈ ਕੀ ਉਸ ਨੂੰ ਜਾਣਕਾਰੀ ਦਿਉ ਕਿ ਸਾਡੇ ਪਿੰਡ ਜਿਹੜੀ ਐਂਬੂਲਸ ਓ ਹੈਗੀ ਹੈ ਉਹ ਖ਼ਰਾਬ ਹੋ ਗਈ ਹੈ ਤਾਂ ਕਿ ਕਲ੍ਹ ਨੂੰ ਕੋਈ ਸਾਨੂੰ ਜ਼ਰੂਰਤ ਹੋਈ ਤਾਂ ਪੂਰੇ ਟਾਈਮ ਨਾਲ ਪੂਰੀ ਨਹੀਂ ਹੁੰਦੀ ਤਾਂ ਬਹੁਤ ਦਿੱਕਤ ਆਉਂਦੀ ਹੈ ਇਸ ਲਈ ਅਸੀਂ ਸਾਡੇ ਸਰਪੰਚ ਨੂੰ ਜਾ ਕੇ ਬੋਲਿਆ ਅਤੇ ਸਰਪੰਚ ਨੇ ਬੋਲਿਆ ਕਿ ਜੋ ਤੁਹਾਡੀ ਐਂਬੂਲਸ ਕਨੈਕਟਵੀਟੀ ਕਾਰਨ ਬਹੁਤ ਸਾਨੂੰ ਚੁਣੌਤੀਆਂ ਮਿਲ ਰਹੀ ਹੈ ਕਿ ਇਸ ਨੂੰ ਠੀਕ ਕਰਵਾਉ ਅਤੇ ਅਸੀਂ ਹੁਣ ਇਸ ਨੂੰ ਐਂਬੂਲਸ ਨੂੰ ਇਹ ਤੁਹਾਡੀ ਚੁਣੌਤੀ ਪੂਰੀ ਕਰਾਂਗੇ ਅਤੇ ਹੁਣ ਇਹ ਤੁਹਾਡੀ ਚੁਣੌਤੀ ਪੂਰੀ ਹੋ ਜਾਵੇਗੀ ਅਤੇ ਜਿਸ ਕਰਕੇ ਤੁਹਾਡੇ ਸਾਰਾ ਧਿਆਨ ਤੁਸੀਂ ਸਹੀ ਹੋ ਜਾਓਗੇ ਤਾਂ ਤੁਹਾਨੂੰ ਕੋਈ ਦਿੱਕਤ ਨਹੀਂ ਆਵੇਗੀ ਅਤੇ ਸਰਪੰਚ ਨੇ ਸਾਡੀ ਪੂਰੀ ਪੂਰੀ ਸੁ ਸਾਡੀ ਆਵਾਜ਼ ਸੁਨੀ ਸੀ